ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪਹਿਲੇ ਸਮੇਂ ਔਰ ਅੱਜ ਦੇ ਸਮੇਂ ਵਿੱਚ ਜੋ ਟਕਨੋਲੋਜੀ ਨੇ ਤਬਦੀਲੀਆਂ ਲਿਆਈਆਂ ਹਨ ਜਿਵੇਂ ਅਸੀਂ ਬੈਂਕਾਂ 'ਚ ਪਹਿਲਾਂ ਜਾ ਕੇ ਸਾਰੇ ਕੰਮ ਅਸੀਂ ਲਾਈਨਾਂ 'ਚ ਖੜ੍ਹ ਕੇ ਆਪ ਕਰਨੇ ਪੈਂਦੇ ਸੀ ਸਾਨੂੰ ਫੋਰਮ ਭਰਨਾ ਸਭ ਕੁਛ ਕਰਨਾ ਅੱਜ ਸਾਰਾ ਕੁਛ ਕੰਪਿਊਟਰ ਦੇ ਰਾਹੀਂ ਫੋਨਾਂ ਦੇ ਰਾਹੀਂ ਹੋ ਜਾਂਦਾ ਹੈ ਟਰੇਨਾਂ ਦੀ ਟਿਕਟਾਂ ਬੁਕ ਕਰਨੀਆਂ ਹੈ ਉਹ ਘਰ ਬੈਠ ਕੇ ਅਸੀਂ ਆਪਣੇ ਫੋਨ 'ਤੇ ਕਰ ਸਕਦੇ ਹਾਂ ਸ਼ੋਸ਼ਲ ਮੀਡੀਆ ਨੇ ਸਾਡੇ ਜੀਵਨ 'ਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪਾਇਆ ਹੈ ਖਾਣਾ ਕੋਈ ਔਰਡਰ ਕਰਨਾ ਉਹ ਵੀ ਅਸੀਂ ਆਪਣੇ ਫੋਨ ਰਾਹੀਂ ਕਰ ਸਕਦੇ ਹਾਂ ਬੈਂਕਾਂ ਦੇ ਕੰਮ ਸਾਰਾ ਕੰਪਿਊਟਰ ਨੇ ਜੋ ਹੈ ਬਹੁਤ ਹੀ ਜ਼ਿਆਦਾ ਆਸਾਨ ਕਰ ਦਿੱਤਾ ਹੈ ਘਰ ਬੈਠ ਕੇ ਅਸੀਂ ਆਪਣੇ ਸਾਰੇ ਕੰਮ ਜੋ ਹੈ ਕਰ ਸਕਦੇ ਹਾਂ ਬੈਂਕ ਅਕਾਊਂਟ ਖੋਲ੍ਹਣਾ ਖਾਣਾ ਔਰਡਰ ਕਰਨਾ ਟਿਕਟਾਂ ਬੁੱਕ ਕਰਨੀਆਂ ਏਅਰ ਟਿਕਟ ਬੁੱਕ ਕਰਨੀਆਂ ਕੁਛ ਵੀ ਜੋ ਵੀ ਕੰਮ ਸੀ ਉਹ ਸਾਰਾ ਜੋ ਹੈ ਕੰਪਿਊਟਰ ਨੇ ਬਹੁਤ ਜ਼ਿਆਦਾ ਹੀ ਆਸਾਨ ਕਰ ਦਿੱਤਾ ਹੈ ਅੱਜ ਦੇ ਸਮੇਂ ਵਿੱਚ ਸਾਨੂੰ ਸਟੇਸ਼ਨਾਂ 'ਤੇ ਖੜ੍ਹ ਕੇ ਟਿਕਟ ਬੁੱਕ ਕਰਨ ਦੀ ਥਾਂ ਅਸੀਂ ਆਪਣੇ ਫੋਨਾਂ 'ਤੇ ਟਿਕਟਸ ਬੁੱਕ ਕਰ ਲੈਂਦੇ ਹਾਂ ਇਹ ਵੀ ਟੈਕਨੋਲੋਜੀ ਦਾ ਬਹੁਤ ਵੱਡਾ ਟੈਕਨੋਲੋਜੀ ਦੀ ਬਹੁਤ ਵੱਡੀ ਇੱਕ ਤਬਦੀਲ ਹੈ ਜੋ ਸਾਡੇ ਲਈ ਸਾਰੇ ਕੰਮ ਬਹੁਤ ਹੀ ਸੌਖੇ ਹੋ ਗਏ ਹਨ ਅਤੇ ਸਾਡੀ ਜੋ ਹੈ ਸਮੇਂ ਦੀ ਬਹੁਤ ਜ਼ਿਆਦਾ ਬੱਚਤ ਹੁੰਦੀ ਹੈ ਸਾਨੂੰ ਹੁਣ ਲਾਈਨਾਂ 'ਚ ਖੜ੍ਹ ਕੇ ਨਹੀਂ ਸਗੋਂ ਆਪਣੇ ਫੋਨਾਂ 'ਤੇ ਹੀ ਜੋ ਹੈ ਸਾਰਾ ਹੀ ਮਤਲਬ ਪ੍ਰੋਵਾਈਡ ਹੋ ਜਾਂਦੀ ਹੈ ਸਾਰੀ ਸਰਵੀਸਿਸ ਜੋ ਹੈ ਵੱਧ ਟੈਕਨੋਲੇਜਿਜ਼ ਜੋ ਹੈ ਬਹੁਤ ਜ਼ਿਆਦਾ ਚੇਂਜ ਹੋ ਗਈਆਂ ਹਨ ਜਿਸ ਨਾਲ ਸਾਡਾ ਸ ਸਾਡੇ ਸਮੇਂ ਦੀ ਵੀ ਬਹੁਤ ਬੱਚਤ ਹੁੰਦੀ ਹੈ ਅਤੇ ਸਾਨੂੰ ਜੋ ਲਾਈਨਾਂ 'ਚ ਖੜ੍ਹਨਾ ਵੀ ਨਹੀਂ ਪੈਂ